ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਵੀ ਕੇ ਟਰੈਵਲ ਖੰਨਾ ਤੋਂ ਬੋਲ ਰਹੇ ਹੋ ਜੀ ਤੁਹਾਡਾ ਮੈਂ ਨੰਬਰ ਆਪਣੇ ਫਰੈਂਡ ਜਗਤਾਰ ਸਿੰਘ ਤੋਂ ਲਿਆ ਸੀਗਾ ਉਹਨਾਂ ਨੇ ਦੱਸਿਆ ਸੀ ਕਿ ਤੁਸੀਂ ਤੁਹਾਡੇ ਕੋਲ ਕਾਫੀ ਕਾਰਾਂ ਜੀਪਾਂ ਹੈਗੀਆਂ ਨੇ ਅਤੇ ਤੁਸੀਂ ਵਾਜਬ ਰੇਟ 'ਤੇ ਨੇੜੇ ਤੇੜੇ ਸੈਰ ਸਪਾਟੇ ਵਾਸਤੇ ਟਰੈਵਲਿੰਗ ਦਾ ਸਾਧਨ ਅਰੇਂਜ ਕਰ ਸਕਦੇ ਹੋ ਸਾਡੇ ਕੁਛ ਰਿਸ਼ਤੇਦਾਰ ਆ ਰਹੇ ਨੇ ਅਤੇ ਉਹ ਸ਼ਿਮਲੇ ਜਾਣਾ ਚਾਹੁੰਦੇ ਸੀਗੇ ਅਤੇ ਉਹ ਹੈਗੇ ਨੇ ਪੰਜ ਛੇ ਜਣੇ ਹੈਗੇ ਨੇ ਛੱਬੀ ਤਰੀਕ ਨੂੰ ਉਹਨਾਂ ਨੇ ਜਾਣਾ ਹੈ ਅਤੇ ਤਿੰਨ ਚਾਰ ਦਿਨ ਰਹਿਣਗੇ ਤੀਹ ਤਰੀਕ ਨੂੰ ਵਾਪਸ ਆ ਜਾਣਗੇ ਇੱਕ ਇੱਕ ਟੈਚੀ ਆ ਉਹਨਾਂ ਕੋਲ ਅਤੇ ਸਮਝੋ ਪੰਜ ਛੇ ਟੈਚੀ ਹੋ ਜਾਣਗੇ ਇਹਦੇ ਵਾਸਤੇ ਕਿਹੜੀ ਕਾਰ ਠੀਕ ਰਹੂਗੀ ਹੋ ਸਕੇ ਤਾਂ ਘੱਟੋ ਘੱਟ ਸਿਕਸ ਸੀਟਰ ਜਾਂ ਸੈਵਨ ਸੀਟਰ ਕਰ ਦਿਓ ਕਿਉਂਕਿ ਸਮਾਨ ਵੀ ਕਾਫੀ ਹੋ ਜਾਣਾ ਹੈ ਅਤੇ ਨਾਲ ਹੋ ਸਕੇ ਤਾਂ ਉਹਦੇ ਜਿਹੜਾ ਅ ਰੂਫ ਟੋਪ ਹੈ ਗੱਡੀ ਦੇ ਉਹ ਵੀ ਨਾਲ ਲਿਆਇਓ ਕਿਉਂਕਿ ਅੰਦਰ ਬੈਠਣ 'ਚ ਸੌਖਾ ਹੋ ਸਕਦਾ ਅਤੇ ਮੈਂ ਕਿਤੋਂ ਹੋਰ ਵੀ ਰੇਟ ਪਤਾ ਕੀਤਾ ਸੀਗਾ ਉਹ ਕਹਿੰਦੇ ਸੀਗੇ ਕਿ ਜੇ ਤਾਂ ਤੁਸੀਂ ਪਰ ਡੇ ਦੇ ਹਿਸਾਬ ਨਾਲ ਕਰੋਂਗੇ ਤਾਂ ਪੰਦਰਾਂ ਸੌ ਰੁਪਇਆ ਤੁਹਾਨੂੰ ਟਬੇਰਾ ਦਾ ਪਵੇਗਾ ਅਤੇ ਡੀਜਲ ਅਲੱਗ ਪਵੇਗਾ ਜਿੰਨੀ ਗੱਡੀ ਚੱਲੇਗੀ ਉਨਾ ਡੀਜ਼ਲ ਦੇਵਾਂਗੇ ਅਤੇ ਬਾਕੀ ਜੇ ਤੁਸੀਂ ਓਵਰਆਲ ਟੂਰ ਦਾ ਤੁਸੀਂ ਕਰਨਾ ਚਾਹੁੰਦੇ ਹੋ ਉਹ ਵੀ ਪਤਾ ਕੀਤਾ ਸੀ ਉਹ ਕਹਿੰਦੇ ਸੀਗੇ ਅਠਾਰਾਂ ਕੁ ਹਜ਼ਾਰ ਰੁਪਇਆ ਲੱਗੂਗਾ ਤਿੰਨ ਚਾਰ ਦਿਨ ਦਾ ਅਤੇ ਤੁਸੀਂ ਉੱਥੇ ਜਾ ਕੇ ਵਾਪਸ ਹੋਣ ਦਾ ਹੀ ਲਵਾਂਗੇ ਉਹਦੇ ਵਿੱਚ ਹੋਰ ਕੋਈ ਖਰਚੇ ਜਿਹੜਾ ਟੋਲ ਟੈਕਸ ਵਗੈਰਾ ਹੈਗਾ ਉਹ ਸਾਰਾ ਅਸੀਂ ਦੇਵਾਂਗੇ ਜੇ ਤੁਸੀਂ ਪੰਦਰਾਂ ਸੌ ਪਰ ਡੇ ਦੇ ਹਿਸਾਬ ਨਾਲ ਕਰਦੇ ਹੋ ਤਾਂ ਇਹ ਵੀ ਦੱਸਣ ਦੀ ਕ੍ਰਿਪਾਲਤਾ ਕਰਿਓ ਕਿ ਜਿਹੜਾ ਟੂਲ ਟੈਕਸ ਜਾਂ ਜਿਹੜੇ ਹੋਰ ਖਰਚੇ ਨੇ ਉਹ ਇਹਦੇ ਵਿੱਚ ਐਡ ਹੋਣ ਹੋਣਗੇ ਕਿ ਨਹੀਂ ਧੰਨਵਾਦ ਜੀ